ਹੈਲੋ ਨਮਸਤੇ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਜਿਹੜੇ ਸਿੰਪਲ ਸੂਟ ਆ ਉਹਨਾਂ ਦਾ ਤਾਂ ਦੋ ਸੌੌ ਰੁਪਇਆ ਲਈਦਾ ਅਤੇ ਜੇ ਸੂਟ ਸਲਵਾਰ ਦੋਨਾਂ ਥੱਲੇ ਲਾਈਨਿੰਗ ਲਗਵਾਉਣੀ ਆ ਤਾਂ ਫਿਰ ਪੰਜ ਸੌ ਰੁਪਇਆ ਲੈਂਦੇ ਹਾਂ ਅਤੇ ਜੇ ਇਕੱਲੇ ਸੂਟ ਦੇ ਨੀਚੇ ਲਗਵਾਉਣੀ ਆ ਅਤੇ ਫਿਰ ਤਿੰਨ ਸੌ

ਹਾਂ ਲੈਸ਼ ਫਿਰ ਉਹ ਜਿਸ ਹਿਸਾਬ ਨਾਲ ਤੁਸੀਂ ਡਿਜ਼ਾਇਨ ਪਵਾਓਗੇ ਤਾਂ ਉਸ ਹੀ ਹਿਸਾਬ ਨਾਲ ਹੀ ਫਿਰ ਰੇਟ ਬਣੂਗਾ ਰੀਲਾਂ ਬੁੱਕਰਮ ਵਗੈਰਾ ਤਾਂ ਕੋਈ ਨਹੀਂ ਅਸੀਂ ਅਰੇਂਜ ਕਰ ਲਈਦਾ ਹੈ ਅਤੇ ਲੈਸ਼ ਫਿਰ ਇਹ ਹੁੰਦਾ ਆ ਨਾ ਕਿ ਤੁਸੀਂ ਆਪਣੀ ਪਸੰਦ ਦੀ ਲਗਵਾਉਣੀ ਆ ਅਤੇ ਫਿਰ ਐਵੇਂ ਅਸੀਂ ਆਪਣੀ ਪਸੰਦ ਦੀ ਲਾਦਾਂਗੇ ਫਿਰ ਤੁਹਾਨੂੰ ਪਸੰਦ ਨਾ ਆਈ ਤਾਂ ਫਿਰ ਇੱਦਾਂ ਇਸ ਲਈ ਤੁਸੀਂ ਆਪ ਹੀ ਪਸੰਦ ਕਰਕੇ ਅਤੇ ਮੈਨੂੰ ਦੇ ਦਿਓ ਫਿਰ ਮੈਂ ਉਹ ਹੀ ਲਗਾ ਦੂੰਗੀ ਉਹ ਵੀ ਉਹਦਾ ਵੀ ਐਂ ਆ ਨਾ ਕਿ ਅਗਰ ਤੁਸੀਂ ਪੱਲੇ ਘੇਰੇ 'ਤੇ ਲਗਵਾਉਣੀ ਆ ਤਾਂ ਫਿਰ ਉਹਦਾ ਅਲੱਗ ਰੇਟ ਹੋਵੇਗਾ ਅਗਰ ਤੁਸੀਂ ਗਲੇ ਅਤੇ ਬਾਹਾਂ 'ਤੇ ਲਗਵਾਉਣਾ ਚਾਹੁੰਦੇ ਹੋ ਫਿਰ ਉਹਦਾ ਅਲੱਗ ਅਗਰ ਤੁਸੀਂ ਖੁਦ ਵੱਲੋਂ ਹੀ ਹਾਂਜੀ ਮੈਂ ਕਿਹਾ ਅਗਰ ਤੁਸੀਂ ਖੁਦ ਵੱਲੋਂ ਹੀ ਕੋਈ ਡਿਜ਼ਾਇਨ ਪਵਾਉਣਾ ਚਾਹੁੰਦੇ ਹੋ ਨਾ ਤਾਂ ਫਿਰ ਉਹਦਾ ਫਿਰ ਅਲੱਗ ਹੀ ਰੇਟ ਲੱਗੇਗਾ ਉਹ ਡਿਜ਼ਾਇਨ ਦੇ ਹਿਸਾਬ ਨਾਲ ਹੀ ਹੈ ਪ੍ਰਾਈਸ ਸਾਰਾ ਅੱਛਾ ਕਿੰਨੇ ਦਿਨਾਂ ਤੱਕ ਚਾਹੀਦਾ ਤੁਹਾਨੂੰ ਹਾਂ ਹਾਂ ਬਣ ਜੂਗਾ ਕੋਈ ਨਹੀਂ ਲਾਈਨਿੰਗ ਲਗਵਾਉਨੀ ਆ ਪੂਰੇ ਸੂਟ ਥੱਲੇ ਸੂਟ ਸਲਵਾਰ ਦੋਨਾਂ 'ਚ ਹਾਂ ਕੋਈ ਨਹੀਂ ਤੁਸੀਂ ਫਿਰ ਫੜਾ ਜਾਇਓ ਸੂਟ ਤਾਂ ਕੋਈ ਨਹੀਂ ਲਗਾਦਾ ਬਣਾ ਦਾਂਗੇ ਤਿੰਨ ਚਾਰ ਦਿਨਾਂ ਤੱਕ ਕੰਪਲੀਟ ਹੋਜੂਗਾ ਦਿਵਾਲੀ ਤੋਂ ਪਹਿਲਾਂ ਪਹਿਲਾਂ ਹੀ ਕਰ ਦਾਂਗੇ ਹੈਲੋ ਹੈਲੋ ਮੈਂ ਕਿਹਾ ਕਿ ਅਗਰ ਤੁਸੀਂ ਕੋਈ ਲੈਸ਼ ਵਗੈਰਾ ਲਗਵਾਉਣੀ ਹੋਵੇ ਨਾ ਤਾਂ ਫਿਰ ਦੱਸ ਦਿਓ ਅਤੇ ਉਹ ਨਾਲ ਹੀ ਖਰੀਦ ਕੇ ਦੇ ਦਿਓ ਹਾਂਜੀ ਹੋਰ ਕੁਛ ਹਾਂਜੀ ਕੋਈ ਨਹੀਂ ਕੋਈ ਨਹੀਂ ਤੁਸੀਂ ਮੈਨੂੰ ਬਸ ਸੂਟ ਫੜਾ ਦਿਓ ਤਾਂ ਕੋਈ ਨਹੀਂ ਤੁਸੀਂ ਪਹਿਲਾਂ ਨਹੀਂ ਕਦੇ ਸਵਾਇਆ ਸਾਡੇ ਕੋਲੋਂ ਸੂਟ ਉਹ ਫਿਰ ਤੁਹਾਡੇ ਤੁਹਾਡੇ ਵਾਲੀ ਸਾਈਡ ਤੋਂ ਹੀ ਆਉਂਦੇ ਤੁਹਾਡੀ ਗੁਆਂਢਣ ਉਹ ਸਵਾਉਂਦੇ ਆ ਸੂਟ ਹਾਂ ਹਾਂਜੀ ਹਾਂਜੀ ਕੋਈ ਨਹੀਂ ਨਹੀਂ ਤਾਂ ਤੁਸੀਂ ਮੈਨੂੰ ਖੁਦ ਫੋਨ ਕਰਕੇ ਪੁੱਛ ਲਿਓ ਕਿ ਕਿੱਥੇ ਹਾਂ ਮੈਂ ਤੁਹਾਨੂੰ ਦੱਸ ਦੂੰਗੀ ਲੋਕੇਸ਼ਨ ਕਿੰਨੇ ਕੁ ਦਿਨਾਂ ਤੱਕ ਦੇ ਜੂੰਗੇ ਅੱਜ ਦੇ ਜੂੰਗੇ ਸੂਟ ਓਕੇ ਚੱਲੋ ਕੋਈ ਨਹੀਂ ਫੜਾ ਜਾਇਓ ਫਿਰ ਸਿਉਣ 'ਤੇ ਵੀ ਟਾਈਮ ਲੱਗੇਗਾ ਚੱਲੋ ਠੀਕ ਓਕੇ